ਪਹਿਲਾ ਪ੍ਰੋਡਕ ਜੋ ਮੈਂ ਆਪਦਾ ਆਨਲਾਈਨ ਖਰੀਦਿਆ ਸੀ ਉਹ ਸੀਗਾ ਉਹ ਹੈ ਟਾਈਮੈਕਸ ਦੀ ਵਾਚ ਜਿਹੜੀ ਕਿ ਮੇਰੇ ਕੋਲ ਅੱਜ ਤੱਕ ਮੌਜੂਦ ਹੈ ਉਹ ਮੈਂ ਵਾਚ ਬਹੁਤ ਹੀ ਚਾਅ ਨਾਲ ਖਰੀਦੀ ਸੀ ਕਿਉਂਕਿ ਉਹ ਮੇਰੀ ਆਨਲਾਈਨ ਪਹਿਲੀ ਖਰੀਦ ਸੀ ਉਸ ਮੈਨੂੰ ਘੜੀਆਂ ਦਾ ਬਹੁਤ ਸ਼ੌਕ ਹੈ ਇਸ ਲਈ ਮੈਂ ਉਹ ਵਾਚ ਖਰੀਦੀ ਸੀ ਜਿਵੇਂ ਕਿ ਕਿਉਂਕਿ ਆਪਾਂ ਨੂੰ ਕੀ ਆ ਜਿਵੇਂ ਨਿੱਜੀ ਜ਼ਿੰਦਗੀ ਵਿੱਚ ਵੀ ਆਪਾਂ ਨੂੰ ਘੜੀਆਂ ਦੀ ਬਹੁਤ ਲੋੜ ਹੁੰਦੀ ਹੈ ਜਿਵੇਂ ਸਕੂਲਸ ਕਾਲਜਿਸ ਵਿੱਚ ਹਨ ਫੋਨ ਕ ਕਲਾਸਿਜ ਵਿੱਚ ਅਲਾਉ ਨਹੀਂ ਹੁੰਦੇ ਪਰ ਜੇ ਟਾਈਮ ਵੇਖਣਾ ਹੋਵੇ ਤਾਂ ਹਮੇਸ਼ਾ ਕੀ ਆ ਫੋਨ ਆਪਾਂ ਵਾਚ ਤੋਂ ਹੀ ਵੇਖਦੇ ਹਾਂ ਤਾਂ ਫਿਰ ਇਸ ਲਈ ਬਾਕੀ ਇਸ ਦੇ ਨਾਲ ਮੈਨੂੰ ਘੜੀਆਂ ਦਾ ਬਹੁਤ ਸ਼ੌਕ ਹੈ ਇਸ ਲਈ ਮੈਂ ਆਪਦੀ ਘੜੀ ਸਭ ਤੋਂ ਪਹਿਲੀ ਚੀਜ਼ ਜਿਹੜੀ ਸੀ ਉਹ ਕ ਉਹ ਘੜੀ ਖਰੀਦੀ ਸੀ ਮੇਰੀ ਘੜੀ ਜੋ ਸੀ ਉਹ ਟਾਈਮੈਕਸ ਦੀ ਸੀ ਤੇ ਅਤੇ ਉਹ ਗਿਆਰ੍ਹਾਂ ਕੁ ਗਿਆਰ੍ਹਾਂ ਸੌ ਦੇ ਅਰਾਊਂਡ ਕੁਛ ਆਈ ਸੀ ਅਤੇ ਉਹ ਅਜੇ ਤੱਕ ਵੀ ਬਹੁਤ ਵਧੀਆ ਚੱਲਦੀ ਹੈ ਟਾਈਮੈਕਸ ਬਹੁਤ ਵਧੀਆ ਕੰਪਨੀਆਂ 'ਚ ਹੋ ਕੇ ਟਾਟਾ ਟਾਟਾ ਟਾਟਾ ਐਂਡ ਸੰਨਜ ਅੰਡਰ ਆਉਂਦੀ ਹੈ ਅਤੇ ਟਾਈਮੈਕਸ ਉਹਦੇ ਵਿੱਚ ਇਹ ਕੀ ਉਹਨੂੰ ਬਹੁਤ ਟਾਈਮ ਹੋ ਗਿਆ ਜੇ ਮੈਂ ਦੱਸਾਂ ਦਾ ਤਿੰਨ ਤੋਂ ਚਾਰ ਸਾਲ ਹੋ ਚੁੱਕੇ ਆ ਪਰ ਉਹ ਅਜੇ ਵੀ ਉਵੇਂ ਦੀ ਉਵੇਂ ਹੈ ਇੱਕ ਵਾਰ ਵਿੱਚ ਦੀ ਮੈਨੂੰ ਸੈਲ ਜ਼ਰੂਰ ਬਦਲਵਾਣੇ ਪਏ ਪਰ ਉਹ ਉਵੇਂ ਦੀ ਉਵੇਂ ਹੈ ਇੱਥੋਂ ਤੱਕ ਕਿ ਮੈਨੂੰ ਜਿਹਨਾਂ ਤੋਂ ਮੈਂ ਸੈਲ ਬਦਲਵਾਏ ਸੀ ਉਹ ਉਹਨਾਂ ਨੇ ਵੀ ਮ ਮੈਨੂੰ ਘੜੀਆਂ ਵਾਲੇ ਨੇ ਵੀ ਆਹੀ ਕਿਹਾ ਸੀ ਵੀ ਤੁਹਾਡੀ ਵਾਚ ਬਹੁਤ ਵਧੀਆ ਹੈ ਤੁਸੀਂ ਆਨਲਾਈਨ ਆਰਡਰ ਕੀਤੀ ਕਿ ਇੱਥੋਂ ਲੈ ਕੇ ਆਏ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਆਨਲਾਈਨ ਆਰਡਰ ਕੀਤੇ ਤਾਂ ਉਹ ਕਹਿੰਦੇ ਤੁਹਾਡੀ ਘੜੀ ਬਹੁਤ ਬਹੁਤ ਵਧੀਆ ਹੈ ਤੁਸੀਂ ਬਹੁਤ ਵਧੀਆ ਕੰਪਨੀ ਦੀ ਘੜੀ ਲਿੱਤੀ ਹੈ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਵੀ ਮੈਂ ਇੱਕ ਪਹਿਲੀ ਵਾਰ ਆਪਦਾ ਇੱਕ ਬਹੁਤ ਵਧੀਆ ਪ੍ਰੋਡਕਟ ਲਿੱਤਾ ਅਤੇ ਜੇ ਜੋ ਮੇਰੇ ਕੋਲ ਅਜੇ ਵੀ ਹੈ ਬਾਕੀ ਹਮੇਸ਼ਾ ਆਪਾਂ ਨੂੰ ਪਤਾ ਹੀ ਹੈ ਪਹਿਲੇ ਜੋ ਵੀ ਆਪਾਂ ਚੀਜ਼ ਲੈਂਦੇ ਹਾਂ ਤਾਂ ਉਹ ਹਮੇਸ਼ਾ ਸਪੈਸ਼ਲ ਹੁੰਦੀ ਹੈ ਤਾਂ ਇਸ ਤਰ੍ਹਾਂ ਹੀ ਉਹ ਆਪਣੀ ਸਪੈਸ਼ਲ ਹੈ ਉਹ ਘੜੀ ਮੇਰੇ ਲਈ ਸਪੈਸ਼ਲ ਹੈ